ਪੰਜਾਬ ਦੀ ਰਾਜ ਪ੍ਰਣਾਲੀ ਦੀ ਸੁਰੱਖਿਆ ਸਭ ਤੋਂ ਪਹਿਲਾਂ ਪੁਲਿਸ ਦੁਆਰਾ ਹੁੰਦੀ ਹੈ ਖੂਫ਼ੀਆ ਏਜੰਸੀਆਂ ਦੁਆਰਾ ਹੁੰਦੀ ਹੈ ਜਦੋਂ ਪੁਲਿਸ ਤੋਂ ਕੰਮ ਵਾਫਰ ਹੋ ਜਾਂਦਾ ਹੈ ਫਿਰ ਉਦੋਂ ਫੌਜ ਨੂੰ ਬੁਲਾਇਆ ਜਾਂਦਾ ਹੈ ਫਿਰ ਫੌਜ ਪੁਲਿਸ ਦੇ ਨਾਲ ਮਿਲ ਕੇ ਉਹ ਸਾਰਾ ਸ਼ਾਂਤੀ ਦਾ ਕੰਮ ਕਰਦੀ ਹੈ ਜਿਸਦੇ ਨਾਲ ਸ਼ਾਂਤੀ ਆ ਜਾਂਦੀ ਹੈ